ਮੈਨੂੰ ਡਾਂਸ ਦੀਆਂ ਵੱਖ ਵੱਖ ਸ਼ੈਲੀਆਂ ਪਸੰਦ ਹਨ ਪਰ ਮੇਰੀਆਂ ਸਭ ਤੋਂ ਵੱਧ ਪਸੰਦੀਦਾ ਸ਼ੈਲੀਆਂ ਹਨ ਭੰਗੜਾ ਇਹ ਪੰਜਾਬੀ ਸੱਭਿਆਚਾਰ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਅਤੇ ਇਸ ਵਿੱਚ ਬਹੁਤ ਊਰਜਾ ਅਤੇ ਜਸ਼ਨ ਹੁੰਦਾ ਹੈ ਦੂਜਾ ਹਿਪ ਹੋਪ ਇਹ ਇੱਕ ਆਧੁਨਿਕ ਅਤੇ ਊਰਜਾਵਾਨ ਸ਼ੈਲੀ ਹੈ ਜੋ ਮੈਨੂੰ ਬਹੁਤ ਪਸੰਦ ਹੈ ਕਲਾਸੀਕਲ ਇਹ ਇੱਕ ਪਰੰਪਰਾਗਤ ਸ਼ੈਲੀ ਹੈ ਜੋ ਮੈਨੂੰ ਬਹੁਤ ਪਸੰਦ ਹੈ ਕਿਉਂਕਿ ਇਸ ਵਿੱਚ ਬਹੁਤ ਜ਼ਿਆਦਾ ਸੁੰਦਰਤਾ ਅਤੇ ਭਾਵਨਾ ਹੁੰਦੀ ਹੈ ਮੈਨੂੰ ਡਾਂਜ ਦੀਆਂ ਐਨੀਆਂ ਸ਼ ਇੰਨਾ ਸ਼ੈਲੀਆਂ ਪਸੰਦ ਹਨ ਕਿਉਂਕਿ ਇਹਨਾਂ ਵਿੱਚ ਬਹੁਤ ਸੁੰਦਰਤਾ ਜਸ਼ਨ ਅਤੇ ਉਰਜਾ ਹੁੰਦੀ ਹੈ